ਪੰਜਾਬੀ ਇੱਕ ਬਹੁਤ ਹੀ ਖੂਬ ਅਤੇ ਪ੍ਰਸਿੱਧ ਭਾਸ਼ਾ ਹੈ ਜੋ ਕਿ ਪੰਜਾਬ ਵਿੱਚ ਬੋਲੀ ਜਾਂਦੀ ਹੈ ਅਤੇ ਪੰਜਾਬ ਦੇ ਬਾਹਰ ਕਈ ਜ਼ਿਲ੍ਹਿਆਂ ਵਿੱਚ ਵੀ ਜੋ ਪੰਜਾਬੀ ਵਸੇ ਨੇ ਉਹ ਅੱਜ ਵੀ ਉਹ ਭਾਸ਼ਾ ਦਾ ਵਰਤਾਅ ਕਰਦੇ ਹਨ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਆਪਾਂ ਕਾਫ਼ੀ ਲੋਕ ਦੇਖਦੇ ਹਾਂ ਪੰਜਾਬੀ ਭਾਸ਼ਾ ਵਿੱਚ ਕਾਫ਼ੀ ਅਜਿਹੇ ਮੁਹਾਵਰੇ ਹਨ ਕਿ ਜੋ ਰੋਜ਼ਾਨਾ ਗੱਲਬਾਤ ਵਿੱਚ ਵਰਤੇ ਜਾਂਦੇ ਹਨ ਜਿਵੇਂ ਕਿ ਇੱਕ ਮੁਹਾਵਰਾ ਹੈ ਵੇਲੇ ਦੀਆਂ ਟੱਕਰਾਂ ਕੁਵੇਲੇ ਦੀਆਂ ਵੇਲੇ ਦੀਆਂ ਮੁਸੀਬਤਾਂ ਕੁਵੇਲੇ ਦੀਆਂ ਟੱਕਰਾਂ ਇਹ ਮੁਹਾਵਰੇ ਦਾ ਅਰਥ ਇਹ ਬਣਦਾ ਹੈ ਕਿ ਸਾਨੂੰ ਮੌਕੇ ਸਿਰ ਕੰਮ ਕਰ ਲੈਣਾ ਚਾਹੀਦਾ ਆ ਨਹੀਂ ਤਾਂ ਬਾਅਦ ਵਿੱਚ ਉਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਰਹਿੰਦਾ ਉਹ ਕੰਮ ਨਾ ਕੀਤੇ ਦੇ ਬਰਾਬਰ ਹੀ ਹੁੰਦਾ ਹੈ ਅਤੇ ਇੱਕ ਮੁਹਾਵਰਾ ਇਹ ਵੀ ਹੈ ਆਪਣੇ ਹੱਥੀਂ ਆਪਣਾ ਕੰਮ ਸਵਾਰੀਏ ਇਹਦਾ ਮਤਲਬ ਇਹ ਹੈ ਕਿ ਸਾਨੂੰ ਆਪਣਾ ਕੰਮ ਆਪ ਕਰ ਲੈਣਾ ਚਾਹੀਦਾ ਹੈ ਉਸ ਤੋਂ ਚੰਗਾ ਕਿ ਆਪਾਂ ਕਿਸੇ ਹੋਰ 'ਤੇ ਨਿਰਭਰ ਹੋਈਏ ਸਾਨੂੰ ਆਪਣਾ ਕੰਮ ਸਮੇਂ ਰਹਿੰਦਿਆ ਆਪ ਹੀ ਕਰ ਲੈਣਾ ਚਾਹੀਦਾ ਹੈ ਪੰਜਾਬੀ ਭਾਸ਼ਾ ਵਿੱਚ ਕਈ ਆਮ ਵਾਕੰਸ਼ ਨੇ ਜੋ ਰੋ ਰੋਜ਼ਾਨਾ ਲਾਈਫ ਵਿੱਚ ਰੋਜ਼ਾਨਾ ਜੀਵਨ ਵਿੱਚ ਆਮ ਤਰ੍ਹਾਂ ਵਰਤੇ ਜਾਂਦੇ ਹਨ ਆਮ ਗੱਲਬਾਤ ਲਈ ਵਰਤੇ ਜਾਂਦੇ ਹਨ ਜਿਵੇਂ ਕਿ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਇਹ ਇਸ ਦਾ ਅਰਥ ਹੈ ਕਿ ਜਿਸ ਦਿਨ ਨਲਾਇਕ ਇਨਸਾਨ ਕੁਝ ਕਰ ਜਾਵੇਗਾ ਉਹ ਦਿਨ ਕਦੇ ਨਹੀਂ ਆ ਸਕਦਾ ਸੋ ਇਹ ਨਸੀਹਤ ਦੇਣ ਲਈ ਵਰਤਿਆ ਜਾਂਦਾ ਹੈ ਮੁਹਾਵਰੇ ਕਾਫ਼ੀ ਹਨ